ਮੈਨੂੰ ਭੰਗੜਾ ਕਰਨ ਦਾ ਬਹੁਤ ਸ਼ੌਂਕ ਸੀਗਾ ਫੇਰ ਮੈਂ ਮਨ ਚ ਸੋਚਿਆ ਕਿ ਮੈਂ ਕਿਸੇ ਪ੍ਰੋਫੈਸ਼ਨਲੀ ਤੌਰ ਤੇ ਕਿਸੇ ਟੀਚਰ ਤੋਂ ਭੰਗੜਾ ਸਿੱਖਾ ਹਨਾ ਭੋਜ ਕੋਲੇ ਜਾਵਾਂ ਕਿ ਜਿਵੇਂ ਮੈਂ ਯੂਟਿਬ ਤੇ ਵੀ ਦੇਖਦੀ ਹੁੰਦੀ ਸੀ ਵੀਡੀਓ ਭੰਗੜੇ ਦੀਆਂ ਯਾ ਰੀਲਾਂ ਵੇਖਦੀ ਹੁੰਦੀ ਸਟਾਗਰਮ ਦੀਆਂ ਫ ਫਿਰ ਮੈਂ ਘਰ ਦੇ ਨਾਲ ਗੱਲ ਕੀਤੀ ਘਰ ਦੇ ਨੇ ਤਾਂ ਕੇਰਾਂ ਮੈਨੂੰ ਕਿਹਾ ਕਿ ਨਹੀਂ ਤੂੰ ਪੜ੍ਾ ਪੜ੍ਹੀ ਜਾਂਦੀ ਤੇ ਬੀਐਡ ਦਾ ਕਾਲਜ ਆ ਕਿ ਤੂੰ ਨਹੀਂ ਭੰਗੜਾ ਕਰਨਾ ਪਰ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਮੈਂ ਸਿੱਖਣਾ ਕਿ ਜਿਵੇਂ ਕਾਲਜ ਵਿੱਚ ਯੂਥ ਫੈਸਟੀਵਲ ਹੁੰਦੇ ਸੱਭਿਆਚਾਰਕ ਮਤਲਬ ਫੈਸਟੀਵਲ ਹੁੰਦੇ ਆ ਹਨਾ ਮੈਂ ਕਿਹਾ ਉਨਾ ਚ ਪਾਰਟੀਸਪੇਟ ਕਰਾਂਗੇ ਭੰਗੜਾ ਕਿਉਂਕਿ ਭੰਗੜਾ ਤਾਂ ਬਹੁਤ ਹ ਐਨਰਜੈਟਿਕ ਡਾਂਸ ਹੈਗਾ ਤੇ ਵਧੀਆ ਵੀ ਲੱਗਦਾ ਘਰਾਂ ਚ ਪੰਜਾਬੀਆਂ ਦੀ ਸ਼ਾਨ ਵੀ ਆ ਭੰਗੜਾ ਅਤੇ ਫਿਰ ਮੈਂ ਸ਼ੁਰੂ ਕਰ ਲਿਆ ਫਿਰ

ਵਧੀਆ ਹੈਲਦੀ ਫੂਡ ਜਿਹਾ ਹਲਕਾ ਜਿਹਾ ਖਾ ਕੇ ਤੇ ਆਪਦਾ ਅਸੀਂ ਲੰਚ ਵੀ ਉਥੇ ਨਾਲ ਹੀ ਲੈ ਜਾਂਦੇ ਸੀ ਕਿਉਂਕਿ ਮੇਰਾ ਭੰਗੜਾ ਜਿਹੜਾ ਕੋਚਿੰਗ ਸੈਂਟਰ ਸੀਗਾ ਉਹ ਥੋੜਾ ਜਿਹਾ ਵਾਟ ਪੈ ਜਾਂਦਾ ਸੀ ਦੂਰ ਪੈ ਜਾਂਦਾ ਸੀਗਾ ਫਿਰ ਅਸੀਂ ਰੋਟੀ ਪਾਣੀ ਆਪਦੀ ਨਾਲ ਲੈ ਜਾਂਦੇ ਸੀਗੇ ਉੱਥੇ ਜਾਂਦੇ ਸੀਗੇ ਤਾਂ ਸਟਾਰਟਿੰਗ 'ਚ ਤਾਂ ਕੋਚਿੰਗ ਜਿਹੜੇ ਸਰ ਸੀਗੇ ਉਹਨਾਂ ਨੇ ਤਾਂ ਪਹਿਲਾਂ ਭੰਗੜਾ ਜਿਹੜਾ ਕੋਚਿੰਗ ਸੈਂਟਰ ਸੀਗਾ ਉਹ ਥੋੜਾ ਜਿਹਾ ਵਾਟ ਪੈ ਜਾਂਦਾ ਸੀ ਦੂਰ ਪੈ ਜਾਂਦਾ ਸੀਗਾ ਫਿਰ ਅਸੀਂ ਰੋਟੀ ਪਾਣੀ ਆਪਦੀ ਨਾਲ ਲੈ ਜਾਂਦੇ ਸੀਗੇ ਉੱਥੇ ਜਾਂਦੇ ਸੀਗੇ ਤਾਂ ਸਟਾਰਟਿੰਗ ਚ ਤਾਂ ਕੋਚਿੰਗ ਜਿਹੜੇ ਸਰ ਸੀਗੇ ਉਹਨਾਂ ਨੇ ਤਾਂ ਪਹਿਲਾਂ ਦ ਸਟਾਰਟਿੰਗ 'ਚ ਤਾਂ ਕੋਚਿੰਗ ਜਿਹੜੇ ਸਰ ਸੀਗੇ ਉਹਨਾਂ ਨੇ ਤਾਂ ਪਹਿਲਾਂ ਸਾਡੀ ਮਨ ਪਸੰਦ ਦੇ ਗਾਣੇ ਲਵਾਈ ਕਿ ਚਲੋ ਅਸੀਂ ਪਹਿਲਾਂ ਬੀਟ ਨੂੰ ਫੜਿਆ ਕਿ ਕਿਵੇਂ ਭੰਗੜਾ ਕਰ ਸਕਦਾ ਫਿਰ ਹੌਲੀ ਹੌਲੀ ਵਧੀਆ ਅਸੀਂ ਸਟੈਪ ਜੇ ਜਿਵੇਂ ਨੋਰਮਲ ਬੇਸਿਕ ਸਟੈਪਸ ਹੁੰਦੇ ਆ ਉਹ ਸਿੱਖ ਲਿਆ ਅਸੀਂ ਫਿਰ ਹੌਲੀ ਹੌਲੀ ਫਿਰ ਹੌਲੀ ਹੌਲੀ ਵਧੀਆ ਅਸੀਂ ਸਟੈਪ ਜੇ ਜਿਵੇਂ ਨੋਰਮਲ ਬੇਸਿਕ ਸਟੈਪਸ ਹੁੰਦੇ ਆ ਉਹ ਸਿੱਖ ਲਏ ਅਸੀਂ ਫਿਰ ਹੌਲੀ ਹੌਲੀ ਸਰ ਨੇ ਫਿਰ ਹੌਲੀ ਹੌਲੀ ਸਭ ਨੇ ਫਿਰ ਹੌਲੀ ਹੌਲੀ ਸਭ ਨੇ ਸਾਨੂੰ ਵਧੀਆ ਫਿਰ ਹੌਲੀ ਹੌਲੀ ਸਭ ਨੇ ਸਾਨੂੰ ਵਧੀਆ ਪ੍ਰੋਫੈਸ਼ਨਲ

ਤਰ ਅਸੀਂ ਉੱਥੇ ਭੰਗੜਾ ਕੀਤਾ ਵਧੀਆ ਉਥੇ ਫਰੈਂਡਸ ਬਣ ਗਏ ਨਾਲ ਸਾਰੇ ਹੁਲਾਰੇ ਮਾਰਤੇ ਸੀ ਅਸੀਂ ਉੱਥੇ ਐ ਖੁਸ਼ ਹੋ ਕੇ ਪੂਰਾ ਭੰਗੜਾ ਸਿੱਖਿਆ ਸੀ ਫਿਰ ਹੁਣ ਜਦੋਂ ਕਾਲਜ 'ਚ ਕੋਈ ਵੀ ਸੱਭਿਆਚਾਰਕ ਮੇਲਾ ਜਾਂ ਯੂਥ ਫੈਸਟੀਵਲ ਕੁਝ ਹਨਾ ਜੇ ਗਾਂ ਵੀ ਆਪਾਂ ਜੇ ਪੜੀਏ ਤਾਂ ਉਹਦੇ ਵਿੱਚ ਗਰੇਸ ਮਾਰਕਸ ਮਿਲਦੇ ਆ ਯੂਥ ਫੈਸਟੀਵਲ ਤੇ ਨਾਲੇ ਭੰਗੜਾ ਜਦੋਂ ਆਪਾਂ ਕਰਦੇ ਆ ਨਾਲ ਉਹਦੀ ਡਰੈਸ ਬੜੀ ਘੈਂਟ ਹੁੰਦੀ ਆ ਭੰਗੜੇ ਦੀ ਨਾਲੇ ਵਧੀਆ ਐਨਰਜੈਟਿਕ ਹੁੰਦਾ ਨਾਲੇ ਕਰਦੇ ਤੇ ਵੀ ਬੜਾ ਘੈਂਟ ਲਾ ਦ ਜਿਵੇਂ ਕੋਈ ਭੰਗੜਾ ਕਰੂਗਾ ਤੇ ਬੜਾ ਸੋਹਣਾ ਇੱਕ ਲੁੱਕ ਜਾਂ ਨਿਕਲ ਕੇ ਆਉਂਦਾ ਨਿੱਖਰ ਕੇ ਆਉਂਦਾ ਇੱਕ ਪੰਜਾਬੀਆਂ ਦੀ ਸ਼ਾਨ ਨਾਲੇ ਵਧੀਆ ਐਨਰਜੈਟਿਕ ਹੁੰਦਾ ਨਾਲੇ ਕਰਦੇ ਤੇ ਵੀ ਬੜਾ ਘੈਂਟ ਲਾ ਜਿਵੇਂ ਕੋਈ ਭੰਗੜਾ ਕਰੂਗਾ ਤਾਂ ਬੜਾ ਸੋਹਣਾ ਇੱਕ ਲੁੱਕ ਜਿਹਾ ਨਿਕਲ ਕੇ ਆਉਂਦਾ ਨਿੱਖਰ ਕੇ ਆਉਂਦਾ ਇੱਕ ਪੰਜਾਬੀਆਂ ਦੀ ਹੁਲਾਰਿਆਂ ਨਾਲ ਮਾਰ ਮਾਰ ਕੇ ਵਧੀਆ ਭੰਗੜਾ ਕਰਦੇ ਆਂ ਅਸੀਂ ਨਾਲ ਤਾਂ ਦਿਲ ਨੂੰ ਖੁਸ਼ੀ ਮਿਲਦੀ ਹ ਨਾਲੇ ਹੋਵੀ ਦੀ ਹੋਬੀ ਆ ਨਾਲੇ ਵਧੀਆ ਆਪ ਨੂੰ ਵੀ ਵਧੀਆ ਫੀਲ ਹੁੰਦਾ ਤੇ ਜਵਾਂ ਸਹੀ ਆ ਸਾਰਾ ਕੰਮ ਤੇ ਵਧੀਆ ਜਨ ਆ ਉੱਥੇ ਸਰੀਰ ਵੀ ਬਣਿਆ ਰਹਿੰਦਾ ਨਾਲੇ ਆਲਸ ਵੀ ਦੂਰ ਹੋ ਗਿਆ ਹੁਣ ਤਾਂ ਤੇ ਵਧੀਆ ਜਾਨੇ ਆ ਉਥੇ ਸਰੀਰ ਵੀ ਬਣਿਆ ਰਹਿੰਦਾ ਨਾਲੇ ਆਲਸ ਵੀ ਦੂਰ ਹੋ ਗਿਆ ਹੁਣ ਤਾਂ ਸਾਡਾ ਜਵਾਂ ਹੁਣ ਪੜ੍ਹਾਈ ਵੀ ਨਾਲ ਨਾਲ ਕਰੀ ਜਾਦੇ ਆ ਬਸ ਅਸੀਂ ਵਧੀਆ ਖੁਸ਼ ਹਾਂ ਹੁਣ ਭੰਗੜਾ ਕਰਕੇ ਤੇ ਆਮ ਦਿਨ ਤਾਂ ਬਸ ਐਹੀ ਲੰਘ ਜਾਂਦਾ ਭੰਗੜਾ ਕਲਾਸ ਵਿੱਚ ਨਾਲ ਨਾਲ ਸਵੇਰੇ ਬੱਸ ਦੋ ਘੰਟੇ ਦੀ ਤੇ ਆਮ ਦਿਨ ਦਾ ਬਸ ਐ ਹੀ ਲੰਘ ਜਾਂਦਾ ਭੰਗੜਾ ਕਲਾਸਿਸ ਵਿੱਚ ਨਾਲ ਨਾਲ ਸਵੇਰੇ ਬਸ ਦੋ ਘੰਟੇ ਦੀ ਭੰਗੜਾ ਪਲਸ ਲਾ ਲੈਦੇ ਆ ਅਸੀਂ